ਹੈਲੋ ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਸਾਡੀ ਗੱਲ ਗੁਰਪ੍ਰੀਤ ਕੌਰ ਨਾਲ ਹੋ ਰਹੀ ਹੈ ਮੈਡਮ ਤੁਹਾਨੂੰ ਤੁਹਾਡਾ ਔਡਰ ਮਿਲ ਗਿਆ ਮੈਡਮ ਤੁਸੀਂ ਮਤਲਬ ਸਾਡੇ ਰਿਵਿਊਸ ਦਉਂਗੇ ਕੁਛ ਕਿ ਤੁਹਾਨੂੰ ਤੁਹਾਡਾ ਔਡਰ ਟਾਈਮ ਸਿਰ ਮਿਲਿਆ ਕਿ ਨਹੀਂ ਮਿਲਿਆ ਠੀਕ ਹੈ ਅਤੇ ਮੈਡਮ ਕੁਛ ਹੋ ਹੋਰ ਕਹਿਣਾ ਚਾਹੁੰਦੇ ਹੋ ਤੁਹਾਨੂੰ ਤੁਹਾਡਾ ਕੋਈ ਵੀ ਔਡਰ ਹੈ ਮਤਲਬ ਠੀਕ ਤਰੀਕੇ ਨਾਲ ਮਿਲਿਆ ਜਿਹੜਾ ਸਾਡਾ ਡਿਲੀਵਰੀ ਕਰਕੇ ਜਾਂਦਾ ਉਸ ਤੋਂ ਵੀ ਤੁਸੀਂ ਸੈਟੀਸਫਾਈ ਹੋ ਸਾਡੀ ਸਰਵਿਸ ਤੋਂ ਓਕੇ ਮੈਡਮ ਤੁਹਾਡਾ ਮਤਲਬ ਸਾਨੂੰ ਦੱਸਣ ਅ ਦੱਸੋਂਗੇ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਪ੍ਰੋਡਕਟ ਜ਼ਿਆਦਾ ਵਧੀਆ ਲੱਗਦੇ ਨੇ ਤਾਂ ਕਿ ਅਸੀਂ ਤੁਹਾਡੀ ਬਿਹਤਰ ਸਰਵਿਸ ਲਈ ਅਸੀਂ ਤੁਹਾਨੂੰ ਉਸ ਤਰ੍ਹਾਂ ਦੇ ਪ੍ਰੋਡਕਟ ਨੇ ਡਿਸਪਲੇਅ ਕਰੀਏ ਆਪਣੀ ਐਪ ਦੇ ਉੱਤੇ ਠੀਕ ਹੈ ਮੈਡਮ ਤਾਂ ਤੁਸੀਂ ਪ੍ਰਾਈਸ ਤੋਂ ਵੀ ਸਾਡੇ ਤੋਂ ਸੰਤੁਸ਼ਟ ਹੋ ਕਿ ਤੁਹਾਨੂੰ ਅੱਛੇ ਵਧੀਆ ਪ੍ਰਾਈਸ 'ਤੇ ਵਧੀਆ ਚੀਜ਼ਾਂ ਮਿਲ ਰਹੀਆਂ ਨੇ ਸਾਡੇ ਐਪ ਦੇ ਥਰੂ ਅਤੇ ਹੋਰ ਮੈਡਮ ਕੁਛ ਕਹਿਣਾ ਚਾਹੋਗੇ ਸਾਡੀ ਸਰਵਿਸ ਦੇ ਬਾਰੇ ਕੁਛ ਤੁਸੀਂ ਕਿਸੇ ਤਰੀਕੇ ਨਾਲ ਵੀ ਕੋਈ ਵੀ ਪ੍ਰੋਬਲਮ ਤਾਂ ਨਹੀਂ ਕਦੇ ਫੇਸ ਕੀਤੀ ਸਾਡੇ ਐਪ ਦੇ ਥਰੂ ਜਿਹੜਾ ਵੀ ਤੁਸੀਂ ਔਡਰ ਕਰਦੇ ਹੋ ਮੈਡਮ ਠੀਕ ਹੈ ਮੈਡਮ ਜੇ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ ਅਸੀਂ ਆਸ਼ਾ ਕਰਦੇ ਹਾਂ ਕਿ ਤੁਹਾਨੂੰ ਅੱਗੇ ਤੋਂ ਵੀ ਵਧੀਆ ਅਸੀਂ ਚੀਜ਼ਾਂ ਪ੍ਰੋਵਾਈਡ ਕਰਦੇ ਰਹੀਏ ਅਤੇ ਟਾਈਮ ਸਿਰ ਦਿੰਦੇ ਰਹੀਏ ਤਾਂ ਕਿ ਸਾਡੇ ਗ੍ਰਾਹਕ ਸਾਡੇ ਤੋਂ ਸੰਤੁਸਟ ਰਹਿਣ ਠੀਕ ਹੈ ਮੈਡਮ ਧੰਨਵਾਦ ਜੀ ਓਕੇ ਮੈਡਮ ਧੰਨਵਾਦ